ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਸਵੀਗੀ ਤੋਂ ਦੋ ਲਾਰ ਸਾਈਜ਼ ਪੀਜ਼ਾ ਆਰਡਰ ਕੀਤੇ ਸੀ ਅਤੇ ਉਹ ਮੈਨੂੰ ਚਾਹੀਦੇ ਹੈ ਵੀ ਦੋ ਘੰਟਿਆਂ ਦੇ ਵਿੱਚ ਵਿੱਚ ਅਤੇ ਇੱਥੋਂ ਤੁਸੀਂ ਮੇਰਾ ਪਤਾ ਨੋਟ ਕਰੋ ਕਈ ਵਾਰ ਐਵੇਂ ਹੁੰਦਾ ਵੀ ਜਿਹੜੇ ਔਡਰ ਮੈਂ ਔਨਲਾਈਨ ਔਡਰ ਕਰਦਾ ਹਾਂ ਉਹ ਗਲਤ ਪਤੇ 'ਤੇ ਪਹੁੰਚ ਜਾਂਦੇ ਹੈ ਤੁਸੀਂ ਬੀ ਬਲੋਕ 'ਚ ਆਉਣਾ ਅਤੇ ਉਹਦੇ ਮਗਰੋਂ ਆਦਰਸ਼ ਕਲੋਨੀ ਪੁੱਛਣਾ ਆਦਰਸ਼ ਕਲੋਨੀ 'ਚ ਜਦੋਂ ਤੁਸੀਂ ਆਓਗੇ ਤਾਂ ਆਦਰਸ਼ ਕਲੋਨੀ ਚੋਂ ਆ ਕੇ ਤੁਸੀਂ ਪੁੱਛਣਾ ਸੁਨੀਤਾ ਅਪਾਰਟਮੈਂਟਸ ਅਤੇ ਸੁਨੀਤਾ ਅਪਾਰਟਮੈਂਟਸ 'ਚ ਜਦੋਂ ਤੁਸੀਂ ਆਓਗੇ ਤਾਂ ਸੁਨੀਤਾ ਅਪਾਰਟਮੈਂਟਸ ਤੋਂ ਇੱਕ ਪੋਸਟ ਆਫਿਸ ਹੈ ਉਹਦੇ ਨਾਲ ਹੀ ਸੱਜੇ ਹੱਥ ਨੂੰ ਪੋਸਟ ਆਫਿਸ ਤੋਂ ਫਿਰ ਤੁਸੀਂ ਖੱਬੇ ਹੱਥ ਨੂੰ ਮੁੜਨਾ ਅਤੇ ਦੋ ਗਲੀ ਫਿਰ ਅੱਗੇ ਜਾਣਾ ਦੋ ਗਲੀ ਫਿਰ ਅੱਗੇ ਜਾ ਕੇ ਫਿਰ ਤੁਹਾਨੂੰ ਇੱਕ ਚੌਂਕ ਦਿਖੇਗਾ ਪਰਸੂ ਰਾਮ ਦਾ ਅਤੇ ਉਸ ਚੌਂਕ ਤੋਂ ਫਿਰ ਤੁਸੀਂ ਸਿੱਧਾ ਜਾਣਾ ਸਿੱਧਾ ਜਾ ਕੇ ਅੱਗੇ ਆਕਾਸ਼ ਅਪਾਰਟਮੈਂਟਸ ਆਉਣ ਆਵੇਗਾ ਆਕਾਸ਼ ਅ ਅਪਾਰਟਮੈਂਟਸ ਦਾ ਪਤਾ ਪੁੱਛ ਲਿਓ ਅਤੇ ਆਕਾਸ਼ ਅਪਾਰਟਮੈਂਟਸ 'ਚ ਜਦੋਂ ਤੁਸੀਂ ਆਓ ਤਾਂ ਤੁਹਾਡੀ ਐਂਟਰੀ ਉੱਥੇ ਜਿਹੜੇ ਅਪਾਰਟਮੈਂਟਸ 'ਚ ਗਾਰਡ ਬੈਠਾ ਉਹ ਤੁਹਾਡੀ ਐਂਟਰੀ ਐਂ ਹੀ ਨਹੀਂ ਕਰਨੀ ਤੁਸੀਂ ਉਹਦੀ ਮੇਰੇ ਨਾਲ ਗੱਲ ਕਰਵਾਇਓ ਉਹਦੇ ਮਗਰੋਂ ਹੀ ਉਹ ਤੁਹਾਨੂੰ ਐਂਟਰ ਐਂਟਰ ਹੋਣ ਦੇਵੇਗਾ ਅਤੇ ਉਹਦੇ ਵਿੱਚ ਵੀ ਰਜਿਸਟਰ ਕਰਨਾ ਪਵੇਗਾ ਤੁਹਾਡਾ ਨਾਮ ਇਹ ਸਾਰਾ ਕੁਝ ਦਰਜ ਕਰਨਾ ਪਵੇਗਾ ਉਹਦੇ ਮਗਰੋਂ ਤੁਸੀਂ ਲੈਫਟ ਲੈਣੀ ਹੈ ਅਤੇ ਛੇਵੇਂ ਫਲੋਰ 'ਤੇ ਆਉਣਾ ਛੇਵੇਂ ਫਲੋਰ 'ਤੇ ਰਾਈਟ ਵਿੰਗ 'ਚ ਮੇਰਾ ਅਪਾਰਟਮੈਂਟ ਹੈ ਅਤੇ ਉੱਥੇ ਜਾ ਕੇ ਜਦੋਂ ਤੁਸੀਂ ਕਮਰਾ ਨੰਬਰ ਛੇ ਸੌ ਪੰਦਰਾਂ 'ਤੇ ਆਓ ਅਤੇ ਕਮਰੇ 'ਤੇ ਆਉਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਕਾਲ ਕਰ ਲਿਓ ਜਾਂ ਫਿਰ ਨੌਕ ਕਰ ਲਿਓ ਕਾਲ ਜਾਂ ਨੌਕ ਕਰਨ ਤੋਂ ਐਂ ਹੋਵੇਗਾ ਵੀ ਅਸੀਂ ਅਪਾਰਟਮੈਂਟ 'ਚ ਕੁੱਤਾ ਰੱਖਿਆ ਅਤੇ ਉਹ ਕਈ ਵਾਰ ਅਣਜਾਣ ਬੰਦੇ ਨੂੰ ਪੈ ਜਾਂਦਾ ਹੁੰਦਾ ਤੇ ਤੁਸੀਂ ਥੋੜ੍ਹਾ ਜਲਦੀ ਆਉਣ ਦੀ ਕੋਸ਼ਿਸ਼ ਕਰੋ ਅਤੇ ਜਦੋਂ ਵੀ ਤੁਸੀਂ ਪਹੁੰਚ ਜਾਓ ਉਦੋਂ ਮੈਨੂੰ ਕਾਲ ਕਰ ਲਿਓ ਜਾਂ ਫਿਰ ਜਾਂ ਡੋਰ ਨੋਕ ਕਰ ਲਿਓ ਤਾਂ ਮੈਂ ਉੱਥੋਂ ਹੀ ਤੁਹਾਡਾ ਆਰਡਰ ਲੈ ਲਵਾਂ ਤਾਂ ਕਿ ਤੁਹਾਨੂੰ ਅੱਗੇ ਹੋਰ ਅੱਗੇ ਨਾ ਆਉਣਾ ਪੈ ਜਾਵੇ ਅਤੇ ਧੰਨਵਾਦ